ਬਰਡ ਵਾਚਿੰਗ ਕਰਨ ਲਈ ਸਾਨੂੰ ਦੂਰਬੀਨ ਅਤੇ ਬਾਇਓਸਕੋਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਉਪਕਰਨ ਨੂੰ ਅਸੀਂ ਸੈਟ ਕਰ ਸਕਦੇ ਹਾਂ ਪਰ ਇਸ ਨੂੰ ਘਰ ਵਿੱਚ ਸੈੱਟ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਇਸ ਨੂੰ ਘਰ ਵਿੱਚ ਉਪਲਬਧ ਹੋਣਾ ਬਹੁਤ ਮੁਸ਼ਕਲ ਹੈ ਇਸ ਲਈ ਤਕਨੀਕਾਂ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਹਨ ਜਿਸ ਨੂੰ ਅਸੀਂ ਘਰ ਵਿੱਚ ਨਹੀਂ ਵਰਤ ਸਕਦੇ ਇਸ ਨੂੰ ਬੱਚਿਆਂ ਤੋਂ ਵੀ ਦੂਰ ਰੱਖ ਕੇ ਹੀ ਕੀਤਾ ਜਾ ਸਕਦਾ ਹੈ ਬਰਡ ਵਾਚਿੰਗ ਕਰਨਾ ਵੈਸੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਬਰਡ ਵਾਚਿੰਗ ਉਪਕਰਨ ਨੂੰ ਸੈਟ ਕਰਨਾ ਤਾਂ ਮੁਸ਼ਕਲ ਹੈ ਹੀ ਹੈ ਨਾਲ ਨਾਲ ਇਸ ਦੀਆਂ ਤਕਨੀਕਾਂ ਸਾਰੀਆਂ ਹੀ ਬਹੁਤ ਮੁਸ਼ਕਲ ਹਨ ਜੋ ਕਿ ਘਰ ਵਿੱਚ ਉਪਲਬਧ ਵੀ ਨਹੀਂ ਹਨ ਘਰ ਵਿੱਚ ਬਰਡ ਵਾਚਿੰਗ ਨੂੰ ਸੈਟ ਕਰਨਾ ਬਹੁਤ ਮੁਸ਼ਕਲ ਹੈ ਨਾਲ ਹੀ ਬਰਡ ਵਾਚਿੰਗ ਉਪਕਰਨ ਸੈਟ ਕਰਨਾ ਵੀ ਬਹੁਤ ਮੁਸ਼ਕਲ ਹੈ ਬਰਡ ਤਰ੍ਹਾਂ ਤਰ੍ਹਾਂ ਦੇ ਬਰਡ ਦੇਖਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਇਹ ਮੈਨੂੰ ਦੇਖਣਾ ਬਹੁਤ ਚੰਗਾ ਲੱਗਦਾ ਹੈ ਨਾਲ ਹੀ ਇਸਨੂੰ ਸੈਟ ਕਰਨਾ ਵੀ ਬਹੁਤ ਮੁਸ਼ਕਲ ਹੈ ਜਿਸ ਲਈ ਸਾਨੂੰ ਘਰ ਵਿੱਚ ਇਸਨੂੰ ਤਿਆਰ ਨਹੀਂ ਕੀਤਾ ਜਾ ਸਕਦਾ ਇਸ ਨੂੰ ਤਿਆਰ ਕਰਨ ਲਈ ਇੱਕ ਵੱਖਰਾ ਕਮਰੇ ਦੀ ਜ਼ਰੂਰਤ ਹੈ ਪਰ ਘਰ ਵਿੱਚ ਛੋਟੇ ਬੱਚੇ ਹੋਣ 'ਤੇ ਉੱਥੇ ਇਹ ਕੰਮ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਬਰਡ ਵਾਚਿੰਗ ਉਪਕਰਨ ਨੂੰ ਸੈਟ ਕਰਨਾ ਮੁਸ਼ਕਲ ਹੈ ਜਿਸ ਨੂੰ ਅਸੀਂ ਦੇਖ ਤਾਂ ਸਕਦੇ ਹਾਂ ਪਰ ਘਰ ਵਿੱਚ ਇਹ ਚੀਜ਼ਾਂ ਨੂੰ ਰੱਖਣਾ ਬਹੁਤ ਮੁਸ਼ਕਲ ਹੈ ਧੰਨਵਾਦ